ਸਤਿ ਸ਼੍ਰੀ ਅਕਾਲ ਜੀ ਮੈਂ ਪੰਦਰ੍ਹਾਂ ਦਿਨ ਪਹਿਲਾਂ ਤੁਹਾਡੇ ਤੋਂ ਟੀ ਸ਼ਰਟਾਂ ਔਡਰ ਕੀਤੀਆਂ ਸੀਗੀਆਂ ਔਨਲਾਈਨ ਅਤੇ ਇਹਨਾਂ ਦੀ ਪੈਕਜਿੰਗ ਬਿਲਕੁਲ ਫਟੀ ਹੋਈ ਨਿਕਲੀ ਅਤੇ ਕਲ ਜਿਹੜਾ ਰੰਗ ਸੀਗਾ ਉਹ ਮੈਂ ਲਾਲ ਮੰਗਵਇਆ ਸੀ ਅਤੇ ਉਹ ਸੰਤਰੀ ਨਿਕਲਿਆ ਅਤੇ ਉਹ ਵੀ ਫੇਡ ਹੋਇਆ ਸੀਗਾ ਕਲਰ ਅਤੇ ਜਿਹੜਾ ਪ੍ਰਿੰਟ ਸੀਗਾ ਉਹ ਬਿਲਕੁਲ ਘਟੀਆ ਨਿਕਲਿਆ ਅਤੇ ਮਾਰਕਿਟ ਨਾਲ਼ੋਂ ਤੁਸੀਂ ਜ਼ਿਆਦਾ ਪ੍ਰਾਈਸ ਰੱਖਿਆ ਹੋਇਆ ਏ ਅਤੇ ਮਾਰਕਿਟ 'ਚ ਬਿਲਕੁਲ ਲੋਅਰ ਪ੍ਰਾਈਸ ਹੈ ਅਤੇ ਕੁਆਲਿਟੀ ਇਹਦੀ ਬਿਲਕੁਲ ਪੂਰੀ ਵਧੀਆ ਨਹੀਂ ਸੀਗੀ ਅਤੇ ਸਮਾਨ ਜਿਹੜਾ ਕਿ ਪੂਰਾ ਨਹੀਂ ਸੀਗਾ ਮੈਂ ਪੰਜ ਟੀ ਸ਼ਰਟਾਂ ਮੰਗਵਾਈਆਂ ਸੀ ਅਤੇ ਤੁਸੀਂ ਚਾਰ ਭੇਜੀਆਂ ਅਤੇ ਜਿਹੜੇ ਡਿਲੀਵਰੀ ਚਾਰਜਿਸ ਸੀਗੇ ਉਹ ਬਹੁਤ ਜ਼ਿਆਦਾ ਸੀਗੇ ਅਤੇ ਜਿਹੜਾ ਸਾਈਜ਼ ਸੀਗਾ ਮੈਂ ਐੱਲ ਮੰਗਵਾਇਆ ਸੀ ਅਤੇ ਤੁਸੀਂ ਐੱਮ ਭੇਜਿਆ ਆ ਅਤੇ ਸਟੀਚਿੰਗ ਉਹਦੀ ਬਿਲਕੁਲ ਵਧੀਆ ਨਹੀਂ ਸੀਗੀ ਇੱਕ ਵਾਸ਼ ਕਰਨ ਤੋਂ ਬਾਅਦ ਹੀ ਉਹਦਾ ਕਲਰ ਫੇਡ ਹੋ ਗਿਆ ਅਤੇ ਨੈਕਸਟ ਟਾਈਮ ਮੈਂ ਇੱਥੋਂ ਬਿਲਕੁਲ ਸ਼ੋਪਿੰਗ ਨਹੀਂ ਕਰਾਂਗੀ ਅਤੇ ਮੇਰੀ ਸਿਸਟਰ ਨੇ ਵੀ ਕੁਝ ਟੀ ਸ਼ਰਟਾਂ ਮੰਗਵਾਈਆਂ ਹੋਈਆਂ ਸੀ ਅਤੇ ਮੈਂ ਉਹਦੀਆਂ ਟੀ ਸ਼ਰਟਾਂ ਦਾ ਔਡਰ ਵੀ ਕੈਂਸਲ ਕੀਤਾ ਏ